ਖੇਡਾਂ ਦੀ ਗੱਲ ਕਰੀਏ ਤਾਂ ਮੈਨੂੰ ਕ੍ਰਿਕਟ ਬਹੁਤ ਸਾਰੀਆਂ ਖੇਡਾਂ ਪਸੰਦ ਹਨ ਪਰ ਬ ਜ਼ਿਆਦਾਤਰ ਮੈਨੂੰ ਕ੍ਰਿਕਟ ਖੇਡਣਾ ਪਸੰਦ ਹੈ ਜੋ ਕਿ ਇੱਕ ਹਿਸਾਬ ਨਾਲ ਫਰੀ ਟਾਈਮ ਵਿੱਚ ਮੈਂ ਇਹਨੂੰ ਖੇਡਣਾ ਵਧੀਆ ਮੰਨਦੀ ਹਾਂ ਮੈਂ ਜਦੋਂ ਵੀ ਸ਼ਾਮ ਟਾਈਮ ਹਰ ਰੋਜ਼ ਪਹਿਲਾਂ ਹੁੰਦਾ ਸੀ ਕਿ ਜਦੋਂ ਮੈਂ ਸ਼ਾਮ ਟਾਈਮ ਫਰੀ ਹੁੰਦੀ ਸੀ ਤਾਂ ਮੈਂ ਆਪਣੇ ਜਿਹੜੇ ਲਾਗੇ ਸਾਡੇ ਗੁਆਂਡੀ ਉਹਨਾਂ ਦੇ ਮੁੰਡੇ ਆ ਜਿਹੜੇ ਉਹਨਾਂ ਨਾਲ ਖੇਡਣ ਚਲ ਜਾਂਦੀ ਸੀ ਅਤੇ ਮੈਨੂੰ ਬਹੁਤ ਵਧੀਆ ਕ੍ਰਿਕਟ ਖੇਡ ਕੇ ਵਧੀਆ ਲੱਗਦਾ ਸੀਗਾ ਅਤੇ ਉਹਨਾਂ ਮੇਰੇ ਜਿਹੜੇ ਭਰਾ ਨੇ ਉਹਨਾਂ ਕੋਲੋਂ ਮੈਨੂੰ ਬਹੁਤ ਵਧੀਆ ਇਸ ਖੇਡ ਬਾਰੇ ਹੋਰ ਵੀ ਵਧੀਆ ਖੇ ਸਿੱਖਣ ਨੂੰ ਮਿਲਿਆ ਉਹਨਾਂ ਦੇ ਨਾਲ ਹਰ ਰੋਜ਼ ਖੇਡਣ ਦੇ ਨਾਲ ਖੇਡਣ ਦੇ ਨਾਲ ਨਾਲ ਮੈਨੂੰ ਬਹੁਤ ਸਾਰੀਆਂ ਕ੍ਰਿਕਟ ਬਾਰੇ ਗੱਲਾਂ ਪਤਾ ਲੱਗੀਆਂ ਜਿਹਦਾ ਕਿ ਮੇਰਾ ਕ੍ਰਿਕਟ ਵਿੱਚ ਹੋਰ ਵੀ ਵਧੀਆ ਮਤਲਬ ਕਿ ਮੈਨੂੰ ਹੋਰ ਜ਼ਿਆਦਾ ਵਧੀਆ ਲੱਗਣ ਲੱਗ ਪਈ ਇਹਨੂੰ ਦੇਖਣਾ ਇਹਨੂੰ ਹਰ ਰੋਜ਼ ਕਿਵੇਂ ਕੋਈ ਵੀ ਜੋ ਵੀ ਖੇਡਦੇ ਸੀ ਉਹਨਾਂ ਬਾਰੇ ਉਹਨਾਂ ਨੂੰ ਦੇਖਣਾ ਉਹਨਾਂ ਦੇ ਬਾਰੇ ਸਮਝਣਾ ਮੈਨੂੰ ਹੋਰ ਵੀ ਜ਼ਿਆਦਾ ਵਧੀਆ ਲੱਗਣ ਲੱਗ ਪਿਆ